ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਐਕਸ ਵਾਈ ਜ਼ੈਡ ਟ੍ਰੈਵਲ ਏਜੰਸੀ ਤੋਂ ਬੋਲ ਰਹੇ ਹੋ ਮੇਰਾ ਨਾਮ ਪੱਲਵੀ ਹੈ ਅੋਰ ਮੈਂ ਪਠਾਨਕੋਟ ਤੋਂ ਰਹਿਣ ਵਾਲੀ ਹਾਂ ਮੈਂ ਤੁਹਾਡੇ ਕੋਲੋਂ ਇੱਕ ਕੈਬ ਬੁੱਕ ਕਰਵਾਈ ਸੀ ਜੋ ਕਿ ਮੈਨੂੰ ਬਹੁਤ ਵਧੀਆ ਲੱਗੀ ਡਰਾਇਵਰ ਉਹਨਾਂ ਕੈਬ ਦਾ ਬਹੁਤ ਵਧੀਆ ਸੀ ਜੋ ਕਿ ਬਹੁਤ ਹੀ ਹਲੀਮੀ ਨਾਲ ਗੱਲ ਕਰਦਾ ਸੀ ਤੁਸੀਂ ਮੈਨੂੰ ਕੈਬ ਦਾ ਕਿਰਾਇਆ ਜੋ ਕਿ ਪੰਜ ਹਜ਼ਾਰ ਰੁਪਏ ਲਗਾਇਆ ਸੀ ਮੈਂ ਕੈਬ ਇਸ ਲਈ ਬੁੱਕ ਕਰਵਾਈ ਸੀ ਕਿਉਂਕਿ ਮੈਂ ਪੁਲੀਸ ਦੀ ਭਰਤੀ ਦੇਖੀ ਸੀ ਉਹਦਾ ਪੇਪਰ ਜਾ ਦੇਣ ਲਈ ਮੈਨੂੰ ਅਮ੍ਰਿਤਸਰ ਜਾਣਾ ਪੈਣਾ ਸੀ ਇਸ ਲਈ ਮੈਂ ਕੈਬ ਬੁੱਕ ਕਰਵਾਈ ਸੀ ਮੈਨੂੰ ਕੈਬ ਜੋ ਕਿ ਬਹੁਤ ਵਧੀਆ ਲੱਗੀ ਡਰਾਈਵਰ ਵੀ ਬਹੁਤ ਹੀ ਹਲੀਮੀ ਨਾਲ ਗੱਲ ਕਰ ਰਿਹਾ ਸੀ ਕੰਡੀਸ਼ਨ ਬਹੁਤ ਵਧੀਆ ਸੀ ਕੈਬ ਦੀ ਪਰ ਕੈ ਮੈਂ ਗੂਗਲ ਪੇ ਨਹੀਂ ਕਰ ਸਕਦੀ ਮੈਂ ਨਕਦ ਭੁਗਤਾਨ ਕਰਨਾ ਚਾਹੁੰਦੀ ਹਾਂ ਕੈਸ਼ ਰਾਹੀਂ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਕੈਸ਼ ਰਾਹੀਂ ਪੈਸੇ ਦੇ ਸਕਦੀ ਹਾਂ ਕਿਉਂਕਿ ਮੇਰਾ ਗੁਗਲ ਪੇ ਜੋ ਕਿ ਹੈ ਸਰਵਰ ਡਾਊਨ ਚੱਲ ਰਿਹਾ ਹੈ ਇਸ ਕਰਕੇ ਮੈਂ ਤੁਸੀ ਮੈਨੂੰ ਹਲ ਦੱਸੋ ਕਿ ਮੈਂ ਕਿਸ ਤਰ੍ਹਾਂ ਤੁਹਾਨੂੰ ਪੇਮੈਂਟ ਕਰ ਸਕਾਂ ਕਿਉਂਕਿ ਮੇਰਾ ਗੁਗਲ ਪੇ ਜੋ ਕਿ ਸਰਵਰ ਬਹੁਤ ਜ਼ਿਆਦਾ ਡਾਊਨ ਚੱਲ ਰਿਹਾ ਹੈ ਮੈਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ 'ਚ ਨਹੀਂ ਪਾ ਸਕਦੀ ਮੈਨੂੰ ਤੁਹਾਡੀ ਕੈਬ ਬਹੁਤ ਵਧੀਆ ਲੱਗੀ ਮੈਂ ਤੁਹਾਡੇ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਨੂੰ ਪੈਸੇ ਕਿੱਦਾਂ ਭੇਜਾਂ ਕਿਸ ਤਰੀਕੇ ਨਾਲ ਤੁਹਾਨ ਤੁਸੀਂ ਮੈਨੂੰ ਕੋਈ ਹਲ ਦੱਸੋ ਤਾਂ ਜੋ ਤੁਸੀਂ ਮੈਂ ਤੁਹਾਡੀ ਪੇਮੈਂਟ ਜਲਦੀ ਤੋਂ ਜਲਦੀ ਕਰ ਸਕਾਂ